ਸਮੇਂ ਦੇ ਨਾਲ ਭਾਸ਼ਾ ਵਿੱਚ ਬਹੁਤ ਤਬਦੀਲੀਆਂ ਆਉਂਦੀਆਂ ਹਨ ਉਸੇ ਹੀ ਤਰ੍ਹਾਂ ਪੰਜਾਬੀ ਵਿੱਚ ਵੀ ਬਹੁਤ ਸ ਸੀ ਤਬਦੀਲੀਆਂ ਆਈ ਹਨ ਜਿਵੇਂ ਕਿ ਬੋਲਣ ਦਾ ਲਹਿਜ਼ਾ ਨਵੇਂ ਨਵੇਂ ਤਰ੍ਹਾਂ ਦੇ ਅੱਖਰ ਅਤੇ ਉਹਨਾਂ ਅੱਖਰਾਂ ਦਾ ਇੱਕ ਤੋਂ ਵੱਧ ਮੀਨਿੰਗ ਮਤਲਬ ਇਹਨਾਂ ਸਾਰੀਆਂ ਇਹਨਾਂ ਸਾਰੀਆਂ ਚੀਜ਼ਾਂਵਾਂ ਨੂੰ ਦੇਖ ਕੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਬਦਲਾਵ ਆਇਆ ਹੈ ਮੈਂ ਆਪਣੇ ਸਮੇਂ ਵਿੱਚ ਪੰਜਾਬੀ ਨੂੰ ਇੱਕ ਮੈਂ ਆਪਣੇ ਸਮੇਂ ਦੇ ਵਿੱਚ ਵੀ ਪੰਜਾਬੀ ਨੂੰ ਬਦਲਦਾ ਹੋਇਆ ਵੇਖਿਆ ਹੈ ਉਹਨਾਂ ਦੇ ਵਿੱਚੋਂ ਜਿਹੜਾ ਕਿ ਮੈਂ ਨਵੇਂ ਨਵੇਂ ਅੱਖਰਾਂ ਨਵੇਂ ਨਵੇਂ ਅੱਖਰ ਜਿਹੜੇ ਕਿ ਬੋਲਣੇ ਸਿੱਖੇ ਸੁਣਨੇ ਦੇ ਸੁਣਨ ਦੇ ਵਿੱਚ ਆਏ ਨਵੇਂ ਨਵੇਂ ਅੱਖਰਾਂ ਦਾ ਮਤਲਬ ਅਲੱਗ ਅਲੱਗ ਅੱਖਰਾਂ ਦਾ ਮਤਲਬ ਦੇਖਿਆ ਅਤੇ ਹੋਰ ਇਸਦੇ ਵਿੱਚ ਆਪਣਾ ਲਹਿਜ਼ਾ ਲਹਿਜ਼ੇ ਵਿੱਚ ਤਬਦੀਲੀ ਆਉਂਦੀ ਹੈ ਇੱਕ ਹੀ ਅੱਖਰ ਨੂੰ ਬਥੇਰੇ ਤਰੀਕੇ ਨਾਲ ਬੋਲਿਆ ਜਾ ਸਕਦਾ ਹੈ ਇਹ ਸਮੇਂ ਦੇ ਨਾਲ ਸਮੇਂ ਦੇ ਨਾਲ ਬ ਬਦਲਦਾ ਹੋਇਆ ਸਾਨੂੰ ਦਿਖਦਾ ਹੈ